ਹਾਂਜੀ ਮੈਨੂੰ ਜਿਵੇਂ ਕਈ ਚੀਜ਼ਾਂ ਆਪਣੇ ਵਧੀਆ ਲੱਗਦੀਆਂ ਹਨ ਜਿਵੇਂ ਕਿ ਮੈਨੂੰ ਆਪਣੇ ਸੂਟ ਹੋਏ ਜਵੈਲਰੀ ਹੋਈ ਇਹਨਾਂ ਦੋ ਚੀਜ਼ਾਂ ਦਾ ਮੈਂ ਬਹੁਤ ਜ਼ਿਆਦਾ ਸ਼ੌਂਕ ਰੱਖਦੀ ਹਾਂ ਕਿਉਂਕਿ ਜਿਵੇਂ ਮੈਂ ਪਹਿਲਾਂ ਜਦੋਂ ਵੀ ਮੈਂ ਸੂਟ ਵਗੈਰਾ ਖਰੀਦਣਾ ਹੁੰਦਾ ਸਭ ਤੋਂ ਪਹਿਲਾਂ ਮੈਂ ਟਰੈਂਡ ਦੇਖਦੀ ਹਾਂ ਜਦੋਂ ਵੀ ਮੈਂ ਟਰੈਂਡ ਦੇਖਦੀ ਹਾਂ ਫਿਰ ਮੈਂ ਸੋਚਦੀ ਹਾਂ ਵੀ ਮੈਨੂੰ ਕਿਹੜਾ ਸੂਟ ਕਿੱਦਾਂ ਪਾਉਣਾ ਚਾਹੀਦਾ ਕਿੱਦਾਂ ਲੱਗਦਾ ਕਿ ਇਹਦੇ ਨਾਲ ਕੀ ਵੇਅਰ ਕਰਨਾ ਕੀ ਨਹੀਂ ਕਰਨਾ ਉਹ ਸਾਰਾ ਮੈਂ ਆਪਣਾ ਜ਼ਿਆਦਾ ਸ਼ੌਂਕ ਰੱਖਦੀ ਹਾਂ ਫਿਰ ਫਿਰ ਮੈਂ ਅੱਛੀ ਤਰ੍ਹਾਂ ਸੂਟ ਪਾ ਕੇ ਫਿਰ ਉਹਦੇ ਨਾਲ ਦੀ ਹੀ ਜਵੈਲਰੀ ਮੈਚਿੰਗ ਕਰਦੀ ਹਾਂ ਇਹ ਜ਼ਿਆਦਾ ਮੇਰਾ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਦਾ ਸਟੈਪ ਆ ਚੱਟਾਨਾਂ ਨੂੰ ਜੋੜਦਾ ਹੈ ਕਿਉਂਕਿ ਜਦੋਂ ਵੀ ਮੈਂ ਕੋਈ ਟਰੈਂਡ ਦੇਖਦੀ ਹਾਂ ਫਿਰ ਮੈਂ ਸੋਚਦੀ ਹਾਂ ਕਿ ਮੈਨੂੰ ਵੀ ਇਹ ਚੀਜ਼ ਪਾਉਣੀ ਚਾਹੀਦੀ ਹੈ ਫਿਰ ਉਸ ਉਸ ਤਰ੍ਹਾਂ ਹੀ ਮੈਂ ਆਪਣਾ ਹਰ ਚੀਜ਼ ਟਰੈਂਡ ਦੇਖ ਕੇ ਕਰਦੀ ਹਾਂ ਉਦਾਹਰਨ ਤੌਰ 'ਤੇ ਫਿਰ ਜਦੋਂ ਅੱਛੀ ਤਰ੍ਹਾਂ ਜਦੋਂ ਮੈਨੂੰ ਸਭ ਪਤਾ ਚੱਲ ਜਾਂਦਾ ਕਿ ਮੇਰੇ 'ਤੇ ਇਹ ਚੀਜ਼ ਸੂਟ ਕਰਦੀ ਹੈ ਫਿਰ ਮੈਂ ਉਸਨੂੰ ਚੰਗੀ ਤਰ੍ਹਾਂ ਕਿਸੇ ਦਾ ਵੇਟ ਨਹੀਂ ਕਰਦੀ ਮੈਂ ਆਪਣੀ ਚੀਜ਼ ਕੋਈ ਵੀ ਚੀਜ਼ ਆ ਖਰੀਦ ਲੈਂਦੀ ਹਾਂ ਜਿਵੇਂ ਕਿ ਅੱਛਾ ਦੁਪੱਟਾ ਹੋ ਗਿਆ ਪੰਜਾਬੀ ਸੂਟ ਹੋ ਗਿਆ ਪੰਜਾਬੀ ਲੈਸ ਹੋ ਗਈ ਦੁਪੱਟਾ ਹੈਵੀ ਹੋ ਗਿਆ ਪਲੇਨ ਸੂਟ ਹੋ ਗਿਆ ਵਰਕ ਵਾਲਾ ਸੂਟ ਹੋ ਗਿਆ ਫਿਰ ਉਸ ਤਰ੍ਹਾਂ ਨਾਲ ਨਾਲ ਮੈਨੂੰ ਜਵੈਲਰੀ ਮੈਚ ਕਰਕੇ ਲੈ ਕੇ ਆਉਂਦੀ ਹਾਂ ਬਹੁਤ ਹੈਵੀ ਦੁਪੱਟੇ ਨਾਲ ਸਿੰਪਲ ਜਵੈਲਰੀ ਸਿੰਪਲ ਸੂਟ ਨਾਲ ਹੈਵੀ ਜਵੈਲਰੀ ਔਰ ਨਾਲ ਦੀ ਹੀ ਸਾਰੇ ਸਾਰੀ ਚੀਜ਼ ਜੁੱਤੀ ਸੂਟ ਮੇਕਅਪ ਸਭ ਮੈਂ ਐਨ ਮੈਚਿੰਗ ਦਾ ਹੀ ਲੈ ਕੇ ਆਉਦੀ ਆ ਕਿਉਂਕਿ ਮੈਨੂੰ ਇਹ ਸਭ ਤੋਂ ਜ਼ਿਆਦਾ ਮੈਂ ਆਪਣੀ ਜ਼ਿੰਦਗੀ ਦਾ ਮਹੱਤਵ ਹਿੱਸਾ ਰੱਖਦੀ ਹਾਂ ਮੈਨੂੰ ਹਰ ਚੀਜ਼ ਬੜੀ ਸ਼ੌਂਕ ਨਾਲ ਪਾਉਣ ਦੀ ਚਾਅ ਰਹਿਤੀ ਹੈ ਕਿਉਂਕਿ ਫਿਰ ਜੇਕਰ ਆਪਣਾ ਆਪਣਾ ਸ਼ੌਂਕ ਹੀ ਆਪਾਂ ਪੂਰਾ ਨਾ ਕਰੇਂਗੇ ਤੋ ਫਿਰ ਕੋਈ ਫ਼ਾਇਦਾ ਨਹੀਂ ਹੈ ਓਕੇ